ਜੀ ਬਿਲਕੁਲ ਇਹ ਗੱਲ ਮੰਨੀ ਜਾ ਸਕਦੀ ਹੈ ਕਿ ਆਵਾਜਾਈ ਦੇ ਸਹੂਲਤਾਂ ਦੀ ਘਾਟ ਜਿਹੜੀ ਸਿਹਤ ਸੰਬੰਧੀ ਸੰਭਾਲ ਤੱਕ ਪਹੁੰਚ ਨੂੰ ਪ੍ਰਭਾਵਿਤ ਕਰਦੀ ਹੈ ਬਿਲਕੁਲ ਜੇਕਰ ਮੈਂ ਆਪਣੇ ਸ਼ਹਿਰ ਗੁਰਦਾਸਪੁਰ ਦੀ ਵੀ ਗੱਲ ਕਰਾਂ ਅਤੇ ਗੁਰਦਾਸਪੁਰ ਦੇ ਵਿੱਚ ਜਿਹੜਾ ਪਹਿਲਾ ਸਿਵਲ ਹੋਸਪਿਟਲ ਸੀਗਾ ਉਹ ਬਿਲਕੁਲ ਸ਼ਹਿਰ ਦੇ ਵਿੱਚ ਸੀਗਾ ਜਿੱਥੇ ਕਿ ਲੋਕਾਂ ਦਾ ਆਉਣਾ ਜਾਣਾ ਸੌਖਾ ਸੀਗਾ ਲੋਕ ਤੁਰ ਕੇ ਵੀ ਚਲੇ ਜਾਂਦੇ ਸੀ ਕਈ ਰਿਕਸ਼ਾ ਕਰਕੇ ਚਲੇ ਜਾਂਦੇ ਸੀ ਨਹੀਂ ਜਿਹੜੇ ਅਫੋਰਡ ਕਰ ਪਾਉਂਦੇ ਸੀਗੇ ਉਹ ਚਲੇ ਜਾਂਦੇ ਸੀ ਪਰ ਹੁਣ ਜਿਹੜਾ ਇਸ ਟਾਈਮ ਹੋਸਪਿਟਲ ਬਣਿਆ ਉਹ ਸ਼ਹਿਰ ਤੋਂ ਬਹੁਤ ਬਾਹਰ ਬਣ ਚੁੱਕਿਆ ਜਿੱਥੇ ਕਿ ਆਮ ਆਦਮੀ ਦਾ ਸਾਈਕਲ 'ਤੇ ਜਾਣਾ ਜਾਂ ਫਿਰ ਤੁਰ ਕੇ ਜਾਣਾ ਸੰਭਵ ਨਹੀਂ ਹੈਗਾ ਜੇਕਰ ਆਪਾਂ ਦੇਖਿਆ ਜਾਏ ਤਾਂ ਇਹ ਜਿਹੜੇ ਸਰਕਾਰੀ ਹੋਸਪੀਟਲ ਵਿੱਚ ਗਰੀਬ ਬੰਦ ਹੀ ਜਾਂਦਾ ਅਗਰ ਉਹ ਗੱਡੀਆਂ ਕਾਰਾਂ ਅਫੋਰਡ ਹਰ ਟਾਈਮ ਨਹੀਂ ਕਰ ਸਕਦਾ ਔਰ ਇੰਨੀ ਦੂਰ ਤੱਕ ਆਟੋ ਵੀ ਸ਼ਹਿਰ ਦੇ ਵਿੱਚ ਨਹੀਂ ਚਲਦੇ ਹੈਗੇ ਜਿਹਦੇ ਕਰਕੇ ਇਹ ਮੈਨੂੰ ਲੱਗਦਾ ਕਿ ਕਾਫੀ ਪਹੁੰਚਣ ਦੇ ਵਿੱਚ ਦਿੱਕਤ ਆਉਂਦੀ ਹੈ ਔਰ ਸਮਾਂ ਵੀ ਕਾਫੀ ਜ਼ਿਆਦਾ ਲੱਗ ਜਾਂਦਾ ਜਿਹਨਾਂ ਕੋਲ ਤਾਂ ਕਾਰਾਂ ਗੱਡੀਆਂ ਹੈਗੀਆਂ ਉਹਨਾਂ ਵਾਸਤੇ ਸ਼ਹਿਰ ਦੇ ਵਿੱਚ ਹੈ ਚਾਹੇ ਸ਼ਹਿਰ ਦੇ ਬਾਹਰ ਹੈ ਉਹਨਾਂ ਨੂੰ ਤਾਂ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਬਟ ਉਹ ਗਰੀਬ ਬੰਦਾ ਜਿਹਨੇ ਸਾਈਕਲ 'ਤੇ ਜਾਣਾ ਜਾਂ ਜਿਹਨੇ ਰਿਕਸ਼ੇ 'ਤੇ ਜਾਣਾ ਜਿਹਨੇ ਆਟੋ 'ਤੇ ਜਾਣਾ ਉਹਦੇ ਲਈ ਬਹੁਤ ਔਖਾ ਹੈ ਸੋ ਇਹ ਚੀਜ਼ ਇਹ ਹੋਣੀ ਚਾਹੀਦੀ ਹੈ ਕਿ ਜਿਹੜੇ ਹੋਸਪਿਟਲ ਆ ਉਹ ਦੇਖ ਕੇ ਬਣਾਉਣੇ ਚਾਹੀਦੇ ਆ ਕਿ ਸ਼ਹਿਰ ਦੇ ਵਿੱਚ ਹੀ ਹੋਣ ਤਾਂ ਕਿ ਹਰ ਕੋਈ ਜਿਹੜਾ ਆਪਣਾ ਇਲਾਜ ਸਮੇਂ ਸਿਰ ਕਰਾ ਸਕਣ ਕਿਉਂਕਿ ਇਹ ਤਾਂ ਇਵੇਂ ਦੀ ਚੀਜ਼ ਹੈ ਜਿੱਥੇ ਥੋੜ੍ਹੀ ਜਿਹੀ ਵੀ ਦੇਰ ਕੀਤੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਮਹਿੰਗੀ ਪੈ ਸਕਦੀ ਹੈ ਸੋ ਇਸ ਕਰਕੇ ਜਿਹੜੇ ਹੋਸਪਿਟਲ ਹੈ ਉਹ ਸ਼ਹਿਰ ਦੇ ਵਿੱਚ ਹੀ ਹੋਣੇ ਚਾਹੀਦੇ ਆ ਓਕੇ